ਪੰਜਾਬ ਵਿੱਚ ਬਹੁਤ ਸਾਰੀਆਂ ਪ੍ਰਮੁੱਖ ਟੈਕਨੋਲਜੀਆਂ ਦੇ ਕਾਨਫਰੰਸਾਂ ਹਨ ਜਿਵੇਂ ਕਿ ਇੰਟਰਨੈਸ਼ਨਲ ਕਾਨਫਰੰਸ ਔਨ ਇਨਵਾਇਰਮੈਂਟਲ ਫੂਡ ਐਗਰੀਕਲਚਰ ਬਾਇਓ ਟੈਕਨੋਲਜੀ ਔਰ ਇੰਟਰਨੈਸ਼ਨਲ ਕਾਨਫਰੰਸ ਔਨ ਸਾਇੰਸ ਇੰਜਨੀਅਰਿੰਗ ਟੈਕਨੋਲਜੀ ਔਰ ਇੰਟਰਨੈਸ਼ਨਲ ਕਾਨਫਰੰਸ ਔ ਔਨ ਅਮਰਜਿੰਗ ਟ੍ਰੈਂਡ ਇੰਨ ਆਰਟੀਫਿਸ਼ਲ ਇੰਟੈਲ ਇੰਟੈਲੀਜੈਂਸੀ ਕਿ ਅ ਜਿਵੇਂ ਕਿ ਕਾਫੀ ਨਿਊ ਵੇਜ਼ ਆ ਕਿ ਆ ਜਿਹੜੇ ਏ ਆਈ ਆ ਉਹ ਕਾਫੀ ਹੈਲਪ ਕਰਨਗੇ ਜਿਹੜੇ ਲੋਕ ਨੇ ਉਹਨਾਂ ਦੀ ਹੁਣ ਇਹ ਇੱਕ ਮਿੱਥ ਵੀ ਚੱਲ ਰਿਹਾ ਕਿ ਅਗਰ ਜਿਹੜੀ ਆਰਟੀਫਿਸ਼ਲ ਇੰਟੈਲੀਜੈਂਸੀ ਆ ਗਈ ਤਾਂ ਜਿਹੜੀ ਲੋਕਾਂ ਦੀ ਜੋਬ ਹੈ ਉਹ ਖ਼ਤਰੇ ਵਿੱਚ ਪੈ ਜਾਵੇਗੀ ਬਟ ਇਹੋ ਜਿਹਾ ਕੁਛ ਵੀ ਨਹੀਂ ਹੈ ਕਿਉਂਕਿ ਅਗਰ ਅ ਉਹ ਅਗਰ ਏ ਆਈ ਆ ਵੀ ਜਾਵੇ ਤਾਂ ਉਸ ਨੂੰ ਚਲਾਉਣ ਲਈ ਵੀ ਸਾਨੂੰ ਜੋ ਹੈ ਲੋਕਾਂ ਦੀ ਜ਼ਰੂਰਤ ਪਵੇਗੀ ਜੋ ਉਸਨੂੰ ਚਲਾ ਸਕਣ ਵਧੀਆ ਤਰੀਕੇ ਨਾਲ ਅਤੇ ਜਿਵੇਂ ਫੂਡ ਐਗਰੀਕਲਚਰ ਐਂਡ ਬਾਇਓ ਟੈਕਨੋਲੋਜੀ ਆ ਉਸ ਵਿੱਚ ਵੀ ਕਿਸਾਨਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਕਿਵੇਂ ਆਪਣੀ ਜਿਹੜੀ ਪੈਦਾਵਾਰ ਆ ਉਹ ਅੱਛੀ ਕਰ ਸਕਦੇ ਆ ਜਾਂ ਉਸ ਪੈਦਾਵਾਰ ਨੂੰ ਕਿਵੇਂ ਵਧਾ ਸਕਦੇ ਆ ਕਿਵੇਂ ਉਸ ਦੀ ਆਊਟਪੁੱਟ ਵਧੀਆ ਕੀਤੀ ਜਾ ਸਕਦੀ ਆ ਅਤੇ ਜਿਵੇਂ ਨਿਊ ਕ੍ਰੋਪ ਪ੍ਰੋਡਕਸ਼ਨ ਕਿਵੇਂ ਕੀਤੀ ਜਾ ਸਕਦੀ ਆ ਜਿਵੇਂ ਫਿਸ਼ਿੰਗ ਮਸ਼ਰੂਮ ਜਾਂ ਪੋਲਟਰੀ ਫਾਰਮ ਆ ਡੇਰੀ ਫਾਰਮ ਇਸ ਤਰੀਕੇ ਨਾਲ ਅਤੇ ਹੁਣੇ ਇਹ ਜਿਵੇਂ ਕਿ ਅ ਦੱਸਿਆ ਜਾਂਦਾ ਹੈ ਕਿ ਇੰਟਰਨੈਸ਼ਨਲ ਕਾਨਫਰੰਸ ਔਨ ਅਮਰਜਿੰਗ ਟ੍ਰੈਂਡ ਇੰਨ ਆਰਟੀਫਿਸ਼ਲ ਇਟੈਲੀਜੈਂਸੀ 'ਤੇ ਜੀ ਟਵੈਂਟੀ ਜਿਹੜਾ ਜਿਹੜਾ ਆ ਉਹ ਇੱਥੇ ਖਾਲਸਾ ਕਾਲਜ ਦੇ ਵਿੱਚ ਕਰਵਾਇਆ ਗਿਆ ਸੀਗਾ ਜਿਹਦੇ ਵਿੱਚ ਕਾਫੀ ਜਿਹੜੇ ਪ੍ਰੋਜੈ ਪ੍ਰੋਜੈਕਟਸ ਨੇ ਹੁਣ ਡਿਸਪਲੇ ਕੀਤੇ ਗਏ ਸੀਗੇ ਜੋ ਆਉਣ ਵਾਲੀ ਜਨਸੰਖਿਆ ਦੇ ਲਈ ਬਹੁਤ ਹੀ ਵਧੀਆ ਹੋਵੇਗਾ ਥੈਂਕ ਯੂ